ਮੇਰਾ ਸਭ ਤੋਂ ਯਾਦਗਾਰ ਬਾਈਕਿੰਗ ਅਨੁਭਵ ਹਿਮਾਚਲ ਦਾ ਸੀ ਜਿਸ ਦੇ ਵਿੱਚੋਂ ਮੈਂ ਰੋਪੜ ਤੋਂ ਲੈ ਕੇ ਹਿਮਾਚਲ ਤੱਕ ਬਾਈਕਿੰਗ ਕੀਤੀ ਅਤੇ ਮੈਂ ਆਪਣੇ ਯਾਰਾ ਦੋਸਤਾਂ ਨਾਲ ਬਾਈਕ ਬਾਈਕਿੰਗ 'ਤੇ ਗਿਆ ਜਿਸਦੇ ਵਿੱਚੋਂ ਅਸੀਂ ਜਾਂਦੇ ਵੇਲੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਿਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਝਰਨੇ ਹੋ ਗਏ ਝਰਨੇ ਦੇਖੇ ਵਾਦੀਆਂ ਦੇਖੀਆਂ ਅਤੇ ਬੜੇ ਬੜੇ ਪਹਾੜ ਸਾਡੇ ਰਸਤੇ ਵਿੱਚ ਆਏ ਉਹਨਾਂ ਦਾ ਅਸੀਂ ਆਨੰਦ ਮਾਣਿਆ ਇਸ ਤੋਂ ਬਾਅਦ ਅਸੀਂ ਜਾ ਕੇ ਵਾਦੀਆਂ ਵਿੱਚ ਰੁਕੇ ਜਿੱਥੋਂ ਦਾ ਮਾਹੌਲ ਕੀ ਬਹੁਤ ਹੀ ਨਜ਼ਾਰੇ ਵਾਲਾ ਸੀਗਾ ਅਸੀਂ ਉਸ ਚੀਜ਼ ਦਾ ਬੜਾ ਆਨੰਦ ਮਾਣਿਆ ਉਸ ਤੋਂ ਬਾਅਦ ਅਸੀਂ ਕੁਝ ਖਾਣ ਪੀਣ ਵਾਲੀਆਂ ਜਗ੍ਹਾਵਾਂ 'ਤੇ ਗਏ ਜਿੱਥੇ ਅਸੀਂ ਖਾਣ ਪੀਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਧੀਆਂ ਉਹਨਾਂ ਦੇ ਵਿੱਚੋਂ ਅਸੀਂ ਮੈਗੀ ਖਾਧੀ ਅਤੇ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਖਾਧਾ ਇਸਦੇ ਨਾਲ ਅਸੀਂ ਠੰਡੀ ਠੰਡੀ ਲੱਸੀ ਪੀਤੀ ਇਸ ਨਾਲ ਹੀ ਫਿਰ ਅਸੀਂ ਝਰਨੇ ਆਵਾ ਝਰਨੇ ਦੇ ਵਿੱਚ ਗਏ ਜਿਸ ਦੇ ਵਿੱਚ ਅਸੀਂ ਨ ਅਸੀਂ ਅਸੀਂ ਨਹਾਏ ਝਰਨੇ ਦਾ ਆਨੰਦ ਮਾਣਿਆ ਅਤੇ ਉਸ ਤੋਂ ਬਾਅਦ ਅਸੀਂ ਸਾਰੇ ਜਣੇ ਮਿਲ ਕੇ ਰਾਸਤੇ ਵਿੱਚ ਰੁਕਣ ਦਾ ਪ੍ਰੋਗਰਾਮ ਬਣਾਇਆ ਅਤੇ ਟੈਂਟ ਲਾਇਆ ਜਿਸ ਦੇ ਵਿੱਚ ਅਸੀਂ ਇੱਕ ਅੱਗ ਬਾਲ ਕੇ ਸਾਰਿਆਂ ਨੇ ਗੱਲਾਂ ਬਾਤਾਂ ਕਰੀਆਂ ਜਿਸ ਨਾਲ ਅਸੀਂ ਸਾਰੇ ਦੋਸਤਾਂ ਨੇ ਇੱਕ ਦੂਜੇ ਨੂੰ ਹੋਰ ਵਧੀਆ ਤਰੀਕੇ ਨਾਲ ਜਾਣਿਆ ਜਿਸ ਨਾਲ ਸਾਨੂੰ ਕਿ ਬੜਾ ਹੀ ਬੜਾ ਮਜ਼ਾ ਆਇਆ ਅਤੇ ਇਹ ਸੀਗਾ ਮੇਰਾ ਬਾਈਕਿੰਗ ਦਾ ਸਭ ਤੋਂ ਖ਼ਾਸ ਅਨੁਭਵ ਕਿਉਂਕਿ ਇਸ ਦੇ ਵਿੱਚ ਮੈਂ ਆਪਣੋ ਆਪਣੇ ਆਪ ਨੂੰ ਵੀ ਹੋਰ ਬਥੇਰੇ ਤਰੀਕੇ ਨਾਲ ਜਾਣਿਆ